ਯੂਟਿਊਬ 'ਤੇ ਮੇਰਾ ਪਸੰਸੀਦਾ ਭੋਜਨ ਵਿਅੰਜਨ ਚੈਨਲ ਰੂਪ ਵਲੋਗਰ ਹੈ ਇਸ ਪ੍ਰੋਗਰਾਮ ਇਸ ਤੋਂ ਇਸ ਚੈਨਲ ਤੋਂ ਮੈਂ ਕਾਫੀ ਕੁਛ ਬਣਾਉਣ ਦੀਆਂ ਬਾਰੇ ਸਿੱਖਿਆ ਖਾਣਾ ਬਣਾਉਣ ਅਤੇ ਵ ਤੋਂ ਇਲਾਵਾ ਮੈਂ ਇਸ ਤੋਂ ਗੁਲਗੁਲੇ ਕਚੌਰੀਆਂ ਦੇ ਬਾਰੇ ਵੀ ਬਣਾਉਣ ਬਾਰੇ ਸਿੱਖਿਆ ਇਸ ਨੂੰ ਦੇਖ ਇਹ ਵੀਡਿਓ ਦੇਖ ਕੇ ਗੁਲਗੁਲੇ ਕਚੌਰੀਆਂ ਬਣਾਉਣ ਦੀ ਵੀਡੀਓ ਦੇਖਣ ਤੋਂ ਬਾਅਦ ਮੈਂ ਇਨ ਇਸ ਨੂੰ ਅਪਣਾਇਆ ਅਤੇ ਮੈਂ ਆਪਣੇ ਘਰ ਵਿੱਚ ਇਹ ਚੀਜ਼ ਬਣਾਈ ਜਦੋਂ ਮੈਂ ਇਸ ਚੀਜ਼ ਨੂੰ ਬਣਾਉਣ ਲਈ ਲਈ ਪਹਿਲਾਂ ਗੁਲਗੁਲਿਆਂ ਦੇ ਲਈ ਮੈਨੂੰ ਸ਼ੱਕਰ ਲੈਣੀ ਪਈ ਉਸ ਸ਼ੱਕਰ ਨੂੰ ਫਿਰ ਮੈਂ ਪਾਣੀ ਵਿੱਚ ਘੋਲਿਆ ਭਿਉਂ ਪਾਣੀ ਵਿੱਚ ਭਿਉਂਣ ਤੋਂ ਬਾਅਦ ਉਸ ਨੂੰ ਆਟੇ ਵਿੱਚ ਮਿਕਸ ਕੀਤਾ ਆਟੇ ਵਿੱਚ ਮਿਕਸ ਕਰਨ ਤੋਂ ਬਾਅਦ ਜਦੋਂ ਤੇ ਕੜਾਹੀ ਵਿੱਚ ਤੇਲ ਗਰਮ ਕਰਨ ਤੋਂ ਬਾਅਦ ਉਸ ਦੇ ਵਿੱਚ ਪਾਏ ਤਾਂ ਬਹੁਤ ਵਧੀਆ ਸੀ ਜਿਹੜੇ ਮੇਰੇ ਗੁਲਗੁਲੇ ਬਣੇ ਇਸ ਤੋਂ ਪਹਿਲਾਂ ਜਦੋਂ ਮੈਂ ਖੁਦ ਆਪਣੇ ਘਰ ਆਪਣੇ ਅਨੁਸਾਰ ਗੁਲਗੁਲੇ ਬਣਾਉਂਦੀ ਸੀ ਤਾਂ ਉਹ ਗੁਲਗੁਲੇ ਕਈ ਵਾਰੀ ਸਖਤ ਹੋ ਜਾਂਦੇ ਸੀ ਪਰ ਜਦੋਂ ਮੈਂ ਇਸ ਚੈਨਲ ਤੋਂ ਦੇਖ ਕੇ ਗੁਲਗੁਲੇ ਬਣਾਉਣ ਦੀ ਵਿਧੀ ਦੇਖੀ ਅਤੇ ਉਸ ਦੇ ਵਿੱਚ ਉਨ੍ਹਾਂ ਨੇ ਦੱਸਿਆ ਵੀ ਥੋੜ੍ਹਾ ਜਿਹਾ ਹਲਕਾ ਗਰਮ ਪਾਣੀ ਲਓ ਅਤੇ ਨਾਲ ਹਲਕਾ ਜਿਹਾ ਮਿੱਠਾ ਸੋਡਾ ਪਾਓ ਤਾਂ ਇਹ ਚੀਜ਼ ਕਰਨ ਤੋਂ ਬਾਅਦ ਮੇਰੇ ਗੁਲਗੁਲੇ ਬਹੁਤ ਵਧੀਆ ਬਣੇ ਇਸੇ ਤਰ੍ਹਾਂ ਹੀ ਮੈਂ ਕਚੌਰੀਆਂ ਦਾ ਦੀ ਰੈਸਪੀ ਵੀ ਇਸ ਤੋਂ ਸਿੱਖੀ ਕਚੌਰੀਆਂ ਦੀ ਰੈਸਪੀ ਵਿੱਚ ਵੀ ਇਨ੍ਹਾਂ ਨੇ ਦੇ ਦੱਸੇ ਮੁਤਾਬਿਕ ਮੇਰੇ ਕਚੌਰੀਆਂ ਬਹੁਤ ਸਵਾਦ ਲੱਗੀਆਂ ਇਸ ਤਰ੍ਹਾਂ ਮੇਰੇ ਪਰਿਵਾਰ ਨੂੰ ਵੀ ਸਾਰੇ ਪਰਿਵਾਰ ਨੂੰ ਬਹੁਤ ਸ ਪਸੰਦ ਆਈਆਂ ਗੁਲਗੁਲੇ ਕਚੌਰੀਆਂ ਦੀ ਰੈਸਪੀ ਇਸ ਤੋਂ ਮੈਂ ਗੁਲਗੁਲੇ ਕਚੌਰੀਆਂ ਬਣਾਉਣਾ ਸਿੱਖੀਆਂ ਯੂਟਿਊਬ ਇੱਕ ਬਹੁਤ ਵਧੀਆ ਹ 'ਚ ਹੈ ਜਿਹਦੇ ਤੋਂ ਇਹ 'ਚ ਕੋਈ ਵੀ ਅਸੀਂ ਭੋਜਨ ਵਿਅੰਜਨ 'ਚ ਸ ਬਾਰੇ ਸਿੱਖ ਸਕਦੇ ਹਾਂ